ਜਿਹੜੇ ਸ਼ਹਿਰ ਦੇ ਵਿੱਚ ਸਿਹਤ ਸੰਭਾਲ ਹੈ ਅਤੇ ਪਿੰਡਾਂ ਦੇ ਵਿੱਚ ਸਿਹਤ ਸੰਭਾਲ ਹੈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਵਾ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਆ ਇਕ ਸਰਕਾਰੀ ਹਸਪਤਾਲ ਆ ਉੱਥੇ ਡਾਕਟਰ ਵੀ ਘੱਟ ਹੁੰਦੇ ਆ ਅਤੇ ਜਿਹੜੇ ਆ ਮਸ਼ੀਨਾਂ ਸਰਕਾਰੀ ਜਿਵੇਂ ਐੱਮ ਆਰ ਆਈ ਹੋਈਆਂ ਜਾਂ ਟੈਸਟਾਂ ਦੇ ਖੂਨ ਬਲੱਡ ਦੇ ਟੈਸਟ ਦੀਆਂ ਮਸ਼ੀਨਾਂ ਹੁੰਦੀਆਂ ਉਹ ਨਹੀਂ ਹੁੰਦੀਆਂ ਅਤੇ ਸ਼ਹਿਰ ਦੇ ਵਿੱਚ ਜਿਹੜੇ ਹਸਪਤਾਲ ਵੱਡੇ ਹੁੰਦੇ ਆ ਡਾਕਟਰ ਵੀ ਜ਼ਿਆਦਾ ਹੁੰਦੇ ਆ ਜ਼ਿਆਦਾ ਡਾਕਟਰਾਂ ਦੀ ਟੀਮ ਹੁੰਦੀ ਪੂਰੀ ਇੱਕ ਉਹਨਾਂ ਦੇ ਵਿੱਚ ਲੈਬ ਉਹਨਾਂ ਦੇ ਵਿੱਚ ਐਕਸਰੇ ਐੱਮ ਆਰ ਆਈ ਜਾਂ ਸਿਟੀ ਸਕੈਨ ਦੀ ਫੈਸਿਲਿਟੀ ਸਾਰੀ ਹੁੰਦੀ ਆ ਜਿਹੜੇ ਪਿੰਡਾਂ ਦੇ ਵਿੱਚ ਲੋਕ ਹੈ ਸਿਹਤ ਸਹੂ ਸਹੂਲਤਾਂ ਵਾ ਉਹਨਾਂ ਦੇ ਵਿੱਚ ਔਕਸੀਜਨ ਵਗੈਰਾ ਵੀ ਨਹੀਂ ਮਿਲਦੀ ਉਹਨਾਂ ਨੂੰ ਕੋਈ ਸਲੰਡਰ ਦੀ ਅਵੇਲੇਬਿਲਟੀ ਨਹੀਂ ਹੁੰਦੀ ਅਤੇ ਸ਼ਹਿਰਾਂ ਦੇ ਜਿਹੜੇ ਹਸਪਤਾਲਾਂ ਦੇ ਵਿੱਚ ਆ ਉਹਨਾਂ ਦੇ ਵਿੱਚ ਇਹ ਵੀ ਫ਼ਰਕ ਹੁੰਦਾ ਵਾ ਵੀ ਉੱਥੇ ਹਸਪਤਾਲ ਵੀ ਉਹਦੇ ਵਿੱਚ ਔਕਸੀਜਨ ਵੀ ਮਿਲਦੀ ਆ ਬਾਕੀ ਜਿਹੜਾ ਜਿਸ ਲੋਕਾਂ ਵੱਲੋਂ ਗੱਲ ਕਰੀਤੀ ਜਾਵੇ ਅਤੇ ਜਿਹੜੇ ਸ਼ਹਿਰ ਦੇ ਵਿੱਚ ਲੋਕ ਉਹ ਪੜ੍ਹੇ ਲਿਖੇ ਹੁੰਦੇ ਆ ਉਹ ਆਪਣੀ ਸਿਹਤ ਦਾ ਧਿਆਨ ਆਪ ਵੀ ਜ਼ਿਆਦਾ ਰੱਖਦੇ ਅਤੇ ਡੋਕਟਰ ਨਾਲ ਸਲਾਹ ਵਾਰ ਵਾਰ ਲੈਂਦੇ ਰਹਿੰਦੇ ਆ ਪਿੰਡਾਂ ਵਿੱਚ ਲੋਕ ਥੋੜ੍ਹੇ ਜਿਹੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਸਿਹਤ ਸੰਬੰਧੀ ਇੰਨੇ ਜਾਗਰੂਕ ਨਹੀਂ ਹੁੰਦੇ ਅਤੇ ਉਹ ਜਿਹੜਾ ਡਾਕਟਰ ਨੂੰ ਕੋਲ ਜ਼ਿਆਦਾ ਜਿਹੜਾ ਜਾਂਦਾ ਖੇਚਲ ਵੀ ਨਹੀਂ ਕਰਦੇ ਬਹੁਤੀ